ਭਾਰਤ ਵਿੱਚ ਕੁਝ ਸਭ ਤੋਂ ਮਹੱਤਵਪੂਰਨ ਸਥਾਨ ਚਿੰਨ੍ਹ ਹੈਗੇ ਹੈ ਜਿਵੇਂ ਲਾਲ ਕਿਲ੍ਹਾ ਅਸ਼ੋਕ ਸਤੰਭ ਅ ਕੁਤੁਬ ਮਿਨਾਰ ਦਿੱਲੀ ਵਿੱਚ ਹੋਰ ਕਈ ਸਾਰੀਆਂ ਚੀਜ਼ਾਂ ਹੈਗੀਆਂ ਤਾਜ ਮਹਿਲ ਹੋ ਗਿਆ ਅਤੇ ਪੰਜਾਬ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰੇ ਕੁਛ ਮ ਹਿੰਦੂ ਮਤ ਦੇ ਮੰਦਰ ਹੈਗੇ ਹੈ ਜਿਵੇਂ ਕੇਦਾਰਰਨਾਥ ਸੋਮਨਾਥ ਮੰਦਿਰ ਅਤੇ ਇਸ ਤੋਂ ਇਲਾਵਾ ਹੋਰ ਜਿਹੜੀ ਦੇਖਣ ਵਾਲੀ ਚੀਜ਼ਾਂ ਹੈਗੀਆਂ ਜਿਵੇਂ ਹਰਮੰ ਅੰਮ੍ਰਿਤਸਰ ਦੇ ਵਿੱਚ ਹੈਗਾ ਆਪਣਾ ਜਲ੍ਹਿਆਂਵਾਲਾ ਬਾਗ ਹੈ ਅਤੇ ਜਿਹੜਾ ਸਾਡਾ ਚਿੰਨ ਹੈਗਾ ਭਾਰਤ ਦਾ ਉਹ ਹੈਗਾ ਚਾਰ ਸ਼ੇਰਾਂ ਵਾਲੀ ਮੂਰਤੀ ਇਹ ਦੇਖਣ ਵਾਲੀ ਹੈ ਸੋ ਜਿਵੇਂ ਲਾਲ ਕਿਲ੍ਹਾ ਹੈ ਲਾਲ ਕਿਲ੍ਹੇ ਤੋਂ ਹਰ ਸਾਲ ਪੰਦਰਾਂ ਅਗਸਤ ਨੂੰ ਰਾਸ਼ਟਰਪਤ ਪ੍ਰਧਾਨ ਮੰਤਰੀ ਤਿਰੰਗਾ ਝੰਡਾ ਲਹਿਰਾਉਂਦੇ ਆ ਅਤੇ ਉੱਥੇ ਆਜ਼ਾਦੀ ਦਿਵਸ ਮਨਾਇਆ ਜਾਂਦਾ ਆ ਅਤੇ ਸਾਊਥ ਦੇ ਵਿੱਚ ਵੀ ਕਈ ਚੀਜ਼ਾਂ ਦੇਖਣ ਵਾਲੀਆਂ ਹੈਗੀਆਂ ਜਿਵੇਂ ਉੱਧਰ ਪਦਮਨਾਵ ਮੰਦਰ ਵਗੈਰਾ ਆ ਕਾਫੀ ਮਸ਼ਹੂਰ ਨੇ ਉਹ ਮੰਦਿਰ ਅਤੇ ਮੁੰਬਈ ਦੇ ਵਿੱਚ ਹੈਗਾ ਗੇਟ ਵੇਅ ਔਫ ਇੰਡੀਆ ਸੋ ਇੱਦਾਂ ਦੇ ਕਈ ਚਿੰਨ੍ਹ ਹੈਗੇ ਆ ਭਾਰਤ ਵਿੱਚ ਜਗ੍ਹਾ ਜਗ੍ਹਾ 'ਤੇ ਆਕਰਸ਼ਣ ਜਿੱਥੇ ਲੋਕ ਘੁੰਮਣ ਜਾਣਾ ਪਸੰਦ ਕਰਦੇ ਆ ਜਾਂ ਦੇਖਣ ਜਾਣਾ ਪਸੰਦ ਕਰਦੇ ਆ ਇੱਥੇ ਸਿਰਫ ਭਾਰਤੀ ਲੋਕ ਹੀ ਨਹੀਂ ਬਾਹਰੋਂ ਵੀ ਵਿਦੇਸ਼ਾਂ ਤੋਂ ਵੀ ਲੋਕ ਜਿਹੜੇ ਆ ਉਹ ਇਹਨਾਂ ਸਥਾਨਾਂ 'ਤੇ ਘੁੰਮਣ ਆਉਂਦੇ ਆ ਇਹਨਾਂ ਨੂੰ ਦੇਖਣ ਆਉਂਦੇ ਆ ਸੋ ਇਹ ਜਿਹੜੇ ਹੈਗੇ ਆ ਮਹੱਤਵਪੂਰਨ ਸਥਾਨ ਹੈ ਇਹ ਭਾਰਤ ਦੇ ਇਤਿਹਾਸ ਨਾਲ ਜੁੜੇ ਹੋਏ ਆ ਬਹੁਤੇ ਤਾਂ ਜਿਵੇਂ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਨਾਲ ਜੁੜੇ ਹੋਏ ਆ ਵੀ ਜਿਵੇਂ ਕਿ ਸ਼ਹੀਦਾਂ ਦੀ ਜਿਹੜਿਆਂ ਨੇ ਆਜ਼ਾਦੀ ਲਈ ਲੜਾਈ ਲੜੀ ਉਹਨਾਂ ਦੀ ਯਾਦ ਵਿੱਚ ਬਣਾਏ ਹੋੇਏ ਆ ਜਿਹੜੇ ਉਹ ਜ਼ਿਆਦਾ ਮਸ਼ਹੂਰ ਨੇ ਜਿਹਨਾਂ ਨੂੰ ਲੋਕ ਜ਼ਿਆਦਾ ਦੇਖਣ ਆਉਂਦੇ ਆ ਆਗਰੇ ਦਾ ਤਾਜ ਮਹਿਲ ਹੈ ਉਹ ਸ਼ਾਹਜਹਾਂ ਦੁਆਰਾ ਬਣਾਇਆ ਗਿਆ ਉਹ ਇੱਕ ਪਿਆਰ ਮੁਹੱਬਤ ਦੀ ਨਿਸ਼ਾਨੀ ਹੈ ਇਹ ਇੱਕ ਮਤਲਬ ਅੱਠਵਾਂ ਅਜੂਬਾ ਵੀ ਇਹਨੂੰ ਮੰਨਿਆ ਜਾਂਦਾ ਦੁਨੀਆਂ ਦਾ ਸੋ ਇਹਨੂੰ ਤਾਂ ਵਿਦੇਸ਼ਾਂ ਤੋਂ ਵੀ ਲੋਕ ਦੇਖਣ ਆਉਂਦੇ ਆ ਅਤੇ ਇੱਕ ਬਹੁਤ ਖੂਬਸੂਰਤ ਕਲਾਕਾਰੀ ਦਾ ਉੱਤਮ ਨਮੂਨਾ ਹੈਗਾ ਇਹ ਸੋ ਇੱਦਾਂ ਦੇ ਹੋਰ ਵੀ ਕਈ ਚ ਹੈਗੇ ਆ ਜਿਹੜੇ ਆਕਰਸ਼ਣ ਦੇ ਕੇਂਦਰ ਹੈ ਜਿਹੜੇ ਭਾਰਤ ਅੰਦਰ ਕਾਫੀ ਕੁਛ ਦੇਖਣ ਵਾਲਾ ਹੈਗਾ ਆ